ਹੈਲੋ ਸਤਿ ਸ਼੍ਰੀ ਅਕਾਲ ਜਨਾਬ ਜੀ ਪੰਜਾਬ ਪੁਲਸ ਚੋਂ ਬੋਲ ਰਹੇ ਹੋ ਮੈਂ ਅੰਕੁਸ਼ ਪੱਤਰਕਾਰ ਬੋਲ ਰਿਹਾ ਜੀ ਪੱਤਰਕਾਰ ਅੰਕੁਸ਼ ਕੁਮਾਰ ਅਤੇ ਮੈਂ ਇੱਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਜੋ ਕਿ ਤੁਸੀਂ ਮਾਨਸਾ ਦੇ ਵਿੱਚੋਂ ਪਰਸੋਂ ਤੁਸੀਂ ਡਰੱਗਜ਼ ਫੜ੍ਹੀ ਹੈਗੀ ਉਹਦੇ 'ਤੇ ਤੁਸੀਂ ਕੀ ਕਾਰਵਾਈ ਕੀਤੀ ਅਤੇ ਉਹਨਾਂ ਦਾ ਕੀ ਕੀਤਾ ਤੁਸੀਂ ਜੋ ਡਰੱਗਜ਼ ਫੜੀ ਆ ਤੁਸੀਂ ਪਰਸੋਂ ਹਾਂਜੀ ਅੱਛਾ ਜੀ ਉਹਨਾਂ ਤੋਂ ਤੁਸੀਂ ਕੇਸ ਪਾ ਕੇ ਉਹਨਾਂ ਤੋਂ ਕੋਈ ਤੁਸੀਂ ਰਿਮਾਂਡ ਵਗੈਰਾ ਮੰਗਿਆ ਉਹਨਾਂ ਤੋਂ ਅਤੇ ਉਹਨਾਂ ਦੇ ਦੋ ਜਿਹੜੇ ਤੁਸੀਂ ਪਰਸੋਂ ਜੋ ਬਲੈਕੀਏ ਫੜੇ ਨੇਗੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਪਿੱਛੋ ਉਹਨਾਂ ਦਾ ਪਿਛੋਕੜ ਜਾਂ ਕਿੱਥੋਂ ਆਉਂਦਾ ਉਹ ਪੁੱਛਣ ਬਾਰੇ ਤੁਸੀਂ ਉਹਨਾਂ ਬਾਰੇ ਤੁਸੀਂ ਮੈਨੂੰ ਥੋੜ੍ਹਾ ਜਿਹਾ ਚਾਨਣਾ ਪਾ ਸਕਦੇ ਹੋਗੇ ਕਿ ਉਹਨਾਂ ਦੇ ਤੁਸੀਂ ਕੀ ਕਾਰਵਾਈ ਕੀਤੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਅਤੇ ਇੱਕ ਇੱਕ ਇਹਦੇ ਵਿੱਚ ਛੋਟਾ ਜਿਹਾ ਸਵਾਲ ਆ ਗਿਆ ਵੀ ਜਿਵੇਂ ਤੁਸੀਂ ਇਹ ਕਹਿੰਦੇ ਵੀ ਬਾਹਰ ਦੇ ਨੇਗੇ ਜਾ ਉਹਦੇ ਕਿਤੇ ਤੁਹਾਨੂੰ ਇਹ ਕਾਰਵਾਈ ਤੋਂ ਇਹ ਪਤਾ ਲੱਗੇ ਵੀ ਉਹਦੀ ਕੋਈ ਕਿ ਜੇ ਇਹਦੇ ਵਿੱਚੋਂ ਪੋਲੀਟਿਕਸ ਜਾਂ ਕਿਸੇ ਹੋਰ ਦਾ ਹੱਥ ਹੋ ਸਕਦਾ ਇਹਦੇ ਵਿੱਚ ਓਕੇ ਠੀਕ ਆ ਇਹਦੇ ਵਿੱਚ ਤੁਹਾਡੇ ਕੇਸ ਦੇ ਵਿੱਚ ਕਿੰਨੇ ਜਾਣੇ ਐਸ ਐਸ ਪੀ ਸਾਹਿਬ ਵੀ ਹੈਗੇ ਨੇਗੇ ਨਾਲ ਤੁਹਾਡੇ ਠੀਕ ਹੈ ਥੈਂਕ ਯੂ ਜੀ